ਅਗਰ ਗੱਲ ਕੀਤੀ ਜਾਵੇ ਸਾਡੇ ਗੁਰਦਾਸਪੁਰ ਡਿਸਟ੍ਰਿਕ ਦੀ ਅਜੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਮੁੱਖ ਤੌਰ 'ਤੇ ਸਿਰਫ ਇੱਕ ਯੂਨੀਵਰਸਿਟੀ ਹੈ ਜਿਸ ਦਾ ਨਾਂ ਹੈ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਅਤੇ ਇਹ ਵੀ ਯੂਨੀਵਰਸਿਟੀ ਅੱਜ ਤੋਂ ਦੋ ਸਾਲ ਪਹਿਲਾਂ ਦੋ ਹਜ਼ਾਰ ਇੱਕੀ ਵਿੱਚ ਬਣੀ ਸੀ ਅਤੇ ਇਸ ਯੂਨੀਵਰਸਿਟੀ ਵਿੱਚ ਹਰ ਤਰ੍ਹਾਂ ਦੇ ਕੋਰਸਿਸ ਤੇ ਹਨ ਪਰ ਦੇਖਿਆ ਜਾਵੇ ਤਾਂ ਕੋਲਜਾਂ ਦੀ ਸੰਖਿਆ ਵੀ ਸਾਡੇ ਗੁਰਦਾਸਪੁਰ ਡਿ ਡਿਸਟ੍ਰਿਕ ਵਿੱਚ ਬਹੁਤ ਹੈ ਅਤੇ ਇਹਨਾਂ ਵਿੱਚ ਸਿੱਖਿਆ ਦੇ ਸਥਾਨ ਵੀ ਬਹੁਤ ਹਨ ਅਤੇ ਸਿੱਖਿਆ ਸਿੱਖੀ ਵੀ ਜਾ ਸਕਦੀ ਹੈ ਕਿਉਂਕਿ ਜੋ ਸ਼ਿਖਸ਼ਕ ਹਨ ਉਹਨਾਂ ਦਾ ਲੈਵਲ ਬਹੁਤ ਵਧੀਆ ਹੈ ਦੇਖੀ ਜਾਵੇ ਗੱਲ ਰੁਜ਼ਗਾਰ ਰੁਜ਼ਗਾਰ 'ਤੇ ਅਗਰ ਅਸੀਂ ਆਈਏ ਤਾਂ ਭਾਰਤ ਸਾਨੂੰ ਪਤਾ ਹੈ ਕਿ ਰੁਜ਼ਗਾਰ ਕੋਸ਼ਿਸ਼ ਕਰ ਰਿਹਾ ਹੈ ਸੁਰਜਨ ਕਰਨ ਦੀ ਪਰ ਅਜੇ ਉਸ ਰਫਤਾਰ ਨਾਲ ਰੁਜ਼ਗਾਰ ਨਹੀਂ ਦੇ ਪਾ ਰਹੇ ਆ ਤਾਂ ਗੁਰਦਾਸਪੁਰ ਡਿਸਟ੍ਰਿਕਟ ਵੀ ਉਸ ਦੀ ਰਾਹ ਹੈ ਇਸ ਵਿੱਚ ਇਚ ਇੱਕ ਔਫਿਸ ਹੈ ਡਿਸਟਰਿਕਟ ਕਲੈਟਰ ਔਫਿਸ ਜੋ ਕਿ ਹਰ ਮਹੀਨੇ ਜਾਂ ਹਰ ਹਫਤੇ ਇੱਕ ਮੇਲਾ ਲਾਉਂਦਾ ਹੈ ਜਿਹਦਾ ਨਾਂ ਰੁਜ਼ਗਾਰ ਮੇਲਾ ਹੁੰਦਾ ਹੈ ਉਸ ਵਿੱਚ ਹੀ ਪ੍ਰਿਆਸ ਕਰਦਾ ਹੈ ਕਿ ਇੱਥੋਂ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ ਜਿਸ ਲਈ ਉਹ ਉੱਥੇ ਟੈਸਟ ਕਰਵਾਉਂਦਾ ਹੈ ਅਤੇ ਉੱਥੇ ਵੱਧ ਤੋਂ ਵੱਧ ਕੰਪਨੀਆਂ ਨੂੰ ਬੁਲਾਉਂਦਾ ਹੈ ਤਾਂ ਕਿ ਕੰਪਨੀਆਂ ਟੈਸਟ ਲੈ ਕੇ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਦੇ ਸਕਣ ਅਤੇ ਇਹ ਵੀ ਪ੍ਰਸਿੱਧ ਕੀਤਾ ਜਾਂਦਾ ਹੈ ਕਿ ਉਹ ਆਪਣਾ ਰੁਜ਼ਗਾਰ ਬਣਾਉਣ ਜਿਹਦੇ ਨਾਲ ਉਹ ਬਾਕੀਆਂ ਨੂੰ ਵੀ ਰੁਜ਼ਗਾਰ ਦੇ ਸਕਣ ਅਤੇ ਰਹੀ ਗੱਲ ਲੀਡਰਸ਼ਿਪ ਦੀ ਤਾਂ ਪਠਾਨਕੋਟ ਅਤੇ ਗੁਰਦਾਸਪੁਰ ਇੱਕ ਡਿਸਟ੍ਰਿਕਟ ਗੁਰਦਾਸਪੁਰ 'ਚ ਹੀ ਆਉਂਦੇ ਹਨ ਜੋ ਕਿ ਇੱਕ ਹੀ ਐੱਮ ਪੀ ਚੁਣਦੇ ਹਨ ਅਤੇ ਇਹ ਇੱਕ ਬਹੁਤ ਵੱਧ ਬਹੁਤ ਮਹੱਤਵਪੂਰਨ ਸੀਟ ਹੈ ਕਿਉਂਕਿ ਇਹ ਜ਼ਿਲ੍ਹੇ ਬਾਰਡਰ ਨਾਲ ਲੱਗਦਾ ਇੱਕ ਜ਼ਿਲ੍ਹਾ ਹੈ ਜਿਸ ਕਰਕੇ ਇਸ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ ਅਤੇ ਇੱਥੋਂ ਦੇ ਜਿਹੜੇ ਨੌਜਵਾਨ ਹਨ ਉਹ ਚੁਣੌਤੀਆਂ ਨੂੰ ਪਾਰ ਕਰਕੇ ਅੱਗੇ ਵੱਧਦੇ ਹਨ ਰਹੀ ਗੱਲ ਇੱਥੋਂ ਦੀ ਗਰੀਬੀ ਦੀ ਤਾਂ ਇੱਥੇ ਗਰੀਬੀ ਉਸ ਹੱਦ ਤੱਕ ਤਾਂ ਨਹੀਂ ਹੈ ਕਿ ਲੋਕਾਂ ਕੋਲ ਆਮ ਜ਼ਿੰਦਗੀ ਜੀਣ ਦੀ ਵੀ ਚੀਜ਼ਾਂ ਨਾ ਹੋਣ ਇੱਥੇ ਆਮ ਜ਼ਿੰਦਗੀ ਆਮ ਬੰਦਾ ਤਰੀਕੇ ਨਾਲ ਜੀ ਸਕਦਾ ਹੈ ਅਤੇ ਇੱਥੇ ਦੇ ਲੋਕ ਦਿਲ ਖੋਲ੍ਹ ਕੇ ਆਰਾਮ ਨਾਲ ਜੀਂਦੇ ਹਨ ਰਹੀ ਗੱਲ ਕਿ ਇੱਥੋਂ ਦੇ ਲੋਕ ਜਿਹੜੀ ਹੈ ਆਪਣਾ ਮਚਿਓਰਟੀ ਕਹੀ ਜਾ ਸਕੇ ਜਾਂ ਜਿਨ੍ਹਾਂ ਨੂੰ ਕਹੀਏ ਕਿ ਹੁਨਰ ਨਿਰਮਾਣ ਇਹ ਸਾਰਾ ਕੁਛ ਜਿਹੜਾ ਆ ਬਹੁਤ ਹੀ ਘੱਟ ਉਮਰ ਵਿੱਚ ਸਿੱਖ ਲੈਂਦੇ ਹੈ ਕਿਉਂਕਿ ਲੋਕਾਂ 'ਤੇ ਚੁਣੌਤੀਆਂ ਬਹੁਤ ਜਲਦੀ ਆ ਜਾਂਦੀਆਂ ਜਿਸ ਕਰਕੇ ਉਹ ਜ਼ਿੰਦਗੀ ਜੀਣਾ ਬਹੁਤ ਛੋਟੀ ਉਮਰ ਹੀ ਸਿੱਖ ਜਾਂਦੇ ਹਨ ਅਤੇ ਇੱਥੋਂ ਦੇ ਲੋਕ ਆਪਣਾ ਰਹਿਣਾ ਸਹਿਣਾ ਇੰਨਾ ਵਧੀਆ ਰੱਖਦੇ ਹਨ ਕਿ ਉਹ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਢਾਲ ਸਕਦੇ ਹਨ ਅਤੇ ਕਿਸੇ ਵੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ ਰਹੀ ਗੱਲ ਇੱਥੋਂ ਦੇ ਲੀਡਰਸ਼ਿਪ ਅਤੇ ਬਾਕੀ ਸਾਰੇ ਮਿਲ ਕੇ ਇਹੀ ਚਾਹੁੰਦੇ ਹਨ ਕਿ ਇੱਥੋਂ ਦੇ ਜ਼ਿਲ੍ਹੇ ਦਾ ਬਹੁਤ ਸਾਰਾ ਵਿਕਾਸ ਹੋ ਸਕੇ ਅਤੇ ਉਸ ਦੇ ਪ੍ਰਿਆਸ ਚੱਲ ਰਹੇ ਹਨ ਹਰ ਚੀਜ਼ ਵਧੀਆ ਤਾਂ ਨਹੀਂ ਹੁੰਦੀ ਉਹਨੂੰ ਵਧੀਆ ਕਰਨ ਦੀ ਕੋਸ਼ਿਸ਼ ਹੁੰਦੀ ਹੈ ਅਤੇ ਇੱਥੋਂ ਦੇ ਸਾਰੇ ਲੀਡਰਸ਼ਿਪ ਹੋਣ ਡੀ ਸੀ ਸਾਹਿਬ ਹੋਣ ਬਾਕੀ ਸਾਰੇ ਕੋਲਜ ਯੂਨੀਵਰਸਿਟੀ ਸਭ ਚਾਹ ਰਹੇ ਹਨ ਕਿ ਇੱਥੋਂ ਦੇ ਜਿਹੜੇ ਲੋਕ ਹਨ ਜਿਸ ਨਾਲ ਕਿ ਨੌਜਵਾਨ ਉਹ ਵਧੀਆ ਤੋਂ ਵਧੀਆ ਪੜ੍ਹ ਲਿਖ ਕੇ ਅੱਗੇ ਵੱਧ ਸਕਣ ਅਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਕੇ ਇੱਥੋਂ ਦਾ ਨਾਮ ਰੋਸ਼ਨ ਤਾਂ ਕਰਨ ਹੀ ਕਰਨ ਆਪਣੇ ਸਟੇਟ ਜੋ ਕਿ ਪੰਜਾਬ ਅਤੇ ਆਪਣੇ ਦੇਸ਼ ਭਾਰਤ ਦਾ ਵੀ ਨਾਮ ਰੋਸ਼ਨ ਕਰਨ ਅਤੇ ਇਹਨੂੰ ਇੱਕ ਬਹੁਤ ਵੱਡੀ ਉੱਚਾਈਆਂ ਤੱਕ ਲੈ ਕੇ ਜਾ ਸਕਣ